ਹੈਲੋ ਸਰ ਮੈਂ ਤੁਹਾਡੇ ਉੱਥੋਂ ਟੈਕਸੀ ਸਟੈਂਡ ਤੋਂ ਟੈਕਸੀ ਕੀਤੀ ਸੀਗੀ ਉਹਦੀ ਮਤਲਬ ਕਿ ਟੈ ਟੈਕਸੀ ਦਾ ਇੱਕ ਤਾਂ ਡਰਾਈਵਰ ਨੂੰ ਬੋਲਣ ਦੀ ਕੋਈ ਉਹ ਨਹੀਂ ਹੈ ਪਤਾ ਨਹੀਂ ਲੱਗਦਾ ਕਿ ਕਿੱਦਾਂ ਗੱਲ ਕਰਨੀ ਹੈਗੀ ਕਿੱਦਾਂ ਨਹੀਂ ਕਰਨੀ ਹੈਗੀ ਦੂਸਰਾ ਇੱਕ ਤਾਂ ਇਹ ਗੱਡੀ ਦੀਆਂ ਸੀਟਾਂ ਵਗੈਰਾ ਫੱਟੀ ਦੀਆਂ ਸੀਟ ਕੋਈ ਵੀ ਸਹੀ ਨਹੀਂ ਹੈ ਨਾ ਅੱਗੇ ਵਾਲੀਆਂ ਨਾ ਪਿੱਛੇ ਵਾਲੀਆਂ ਕੋਈ ਕੰਫਰਟੇਬਲ ਨਹੀਂ ਹੈਗਾ ਉਸ ਤੋਂ ਬਾਅਦ ਅਗਰ ਅਸੀਂ ਚੱਲੇ ਦੇ ਆ ਕੇ ਇਲਾਕੇ 'ਚ ਟਾਇਰ ਤੁਹਾਡੇ ਬੜੇ ਮਾੜੇ ਹੈਗੇ ਗੱਡੀ ਦੇ ਟਾਇਰ ਦੋ ਵਾਰੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਪਰਿਵਾਰ ਮੇਰਾ ਖੱਜਲ ਹੋ ਗਿਆ ਹਾਰਨ ਗੱਡੀ ਦੇ ਨਹੀਂ ਵੱਜਦੇ ਹੈਗੇ ਗੱਡੀ ਦਾ ਹਾਰਨ ਹਨ ਖਰਾਬ ਲਾਈਟ ਬਿਲ ਬਿਲਕੁਲ ਨਹੀਂ ਡੀਮ ਹੈਗੀ ਹੈ ਹਨੇਰੇ ਦੇ ਵਿੱਚ ਚੱਲੇ ਦੇ ਅਸੀਂ ਗੱਡੀ ਸਹੀ ਨਹੀਂ ਚੱਲਦੀ ਪਈ ਡਰਾਈਵਰ ਉਹਨ ਨਛੇੜੀ ਜਿਹੇ ਟਾਈਪ ਦਾ ਮੈਨੂੰ ਡਰਾਈਵਰ ਲੱਗਦਾ ਪਿਆ ਆ ਬੇਕਾਰ ਜੀ ਗੱਡੀ ਚਲਾਉਂਦਾ ਵਾ ਗੱਡੀ ਬੜੀ ਬੇਕਾਰ ਆ ਤੁਹਾਡੀ ਡਰਾਈਵਰ ਤਾਂ ਬੇਕਾਰ ਹੈਗਾ ਹੀ ਹੈਗਾ ਗੱਡੀ ਬੜੀ ਬੇਕਾਰ ਹੈਗੀ ਆ ਤੁਹਾਡੇ ਟਰਾਂਸਪੋਰਟ ਦੀ ਮੈਂ ਤੁਹਾਨੂੰ ਏ ਇਹ ਹੀ ਕਹਾਂਗਾ ਕਿ ਦੁਬਾਰਾ ਤੁਹਾਡੀ ਕੋਈ ਟੈਕਸੀ ਨਾ ਹੀ ਕਰੇਗਾ ਤਾਂ ਚੰਗੀ ਗੱਲ ਹੈ ਤੁਹਾਡੇ ਪੈਸੇ ਕੱਟੇ ਜਾਣਗੇ ਪੂਰੀ ਪੇਮੈਂਟ ਮੈਂ ਨਹੀਂ ਕਰਾਂਗਾ ਮੈਂ ਜਿੰਨੀ ਤੁਹਾਨੂੰ ਐਡਵਾਂਸ ਦਿੱਤਾ ਤਾ ਹੈਗਾ ਆ ਉੰਨਾ ਹੀ ਤੁਹਾਨੂੰ ਮਿਲਣਾ ਆ ਇਸ ਤੋਂ ਅੱਗੇ ਮੈਂ ਇਲਾਵਾ ਇੱਕ ਰੁਪਇਆ ਨਹੀਂ ਦੇਣਾ ਹੈਗਾ ਤੁਹਾਨੂੰ